ਪ੍ਰਿਥਵੀ ਨੂੰ ਧਰਤੀ ਨੂੰ ਛੱਡ ਕੇ ਹੋਰ ਗ੍ਰਹਿਆਂ 'ਤੇ ਜੀਵਨ ਸੰਭਵ ਨਹੀਂ ਹੈ ਕਿਉਂਕਿ ਕਈ ਗ੍ਰਹਿਆਂ 'ਤੇ ਪਾਣੀ ਨਹੀਂ ਹੈ ਅਤੇ ਕਈਆਂ ਦੇ ਹਵਾ ਨਹੀਂ ਹੈਗੀ ਸਿਰਫ਼ ਇੱਕ ਧਰਤੀ ਹੀ ਇੱਕ ਐਸਾ ਗ੍ਰਹਿ ਹੈ ਜਿਹੜੀ ਜੀਵਨ ਰਹਿਣ ਜਿੱਥੇ ਜੀਵਨ ਬਤੀਤ ਕਰਨ ਦੇ ਕਾਬਿਲ ਹੈ ਔਰ ਕੁਛ ਦਿਲਚਸਪ ਸਿਧਾਂਤ ਹਨ ਜਿਨ੍ਹਾਂ ਵੈਸੇ ਪੜ੍ਹਿਆ ਹੈ ਜਿਵੇਂ ਕਿ ਪਿੱਛੇ ਹੀ ਥੋੜ੍ਹੀ ਦੇਰ ਪਹਿਲਾਂ ਜਿਹੜੇ ਚੰਦਰਯਾਨ ਗਿਆ ਹੈ ਅਤੇ ਮੰਗਲ ਗ੍ਰਹਿ ਦੀ ਸਥਿੱਤੀ ਬਾਰੇ ਸਾਨੂੰ ਰੋਚਕ ਜਾਣਕਾਰੀ ਮਿਲੀ ਹੈ ਅਤੇ ਕੁਛ ਕੁਛ ਨਵੇਂ ਤੱਥ ਸਾਹਮਣੇ ਆਏ ਹਨ ਜਿਹੜੇ ਸਾਨੂੰ ਉਸ ਗ੍ਰਹਿ ਦੇ ਜੀਵਨ ਬਾਰੇ ਦੱਸਦੇ ਹਨ ਅਤੇ ਦੂਸਰਾ ਗ੍ਰਹਿਆਂ 'ਤੇ ਜੀਵਨ ਇਸ ਤਰ੍ਹਾਂ ਸੰਭਵ ਨਹੀਂ ਹੈ ਕਿ ਪ ਪੂਰੀ ਤਰ੍ਹਾਂ ਹਵਾ ਪਾਣੀ ਜਿਹੜੀ ਜ਼ਿੰਦਗੀ ਜੀਣ ਵਾਸਤੇ ਜ਼ਰੂਰੀ ਹੁੰਦਾ ਉੱਥੇ ਉਪਲੱਬਧ ਨਹੀਂ ਹੈ